ਜਿਵੇਂ ਕਿ ਆਪਾਂ ਸੁਰੱਖਿਆ ਦੇ ਮਹੱਤਵਪੂਰਨ ਵਿਚਾਰਾਂ ਬਾਰੇ ਗੱਲ ਕਰੀਏ ਜਿਵੇਂ ਕਿ ਮੈਂ ਸਾਈਕਲ ਚਲਾਉਂਦਾ ਗਾ ਸਵੇਰੇ ਮੈਂ ਸੈਰ 'ਤੇ ਜਾਂਦਾ ਸਾਈਕਲ 'ਤੇ ਤਾਂ ਸਾਈਕਲ ਦੇ ਵਿੱਚ ਸਭ ਨੂੰ ਪਹਿਲਾਂ ਮੈਂ ਇੱਕ ਪਾਣੀ ਵਾਲੀ ਬੋਤਲ ਵੀ ਰੱਖਦਾ ਵੀ ਉਹ ਰਸਤੇ ਵਿੱਚ ਕਦੇ ਪਿਆਸ ਲੱਗਦੀ ਆ ਤਾਂ ਉਹ ਪੀ ਲੈਂਦੇ ਹਾਂ ਇੱਕ ਮੈਂ ਸਾਈਕਲ ਦੇ ਉੱਪਰ ਹੈਲਮਟ ਵੀ ਲੈ ਕੇ ਜਾਂਦਾ ਤਾਂ ਜੋ ਕਈ ਵਾਰ ਕੋਈ ਹਾਦਸਾ ਹੋਵੇ ਤਾਂ ਸਿਰ ਦੇ ਵਿੱਚ ਚੋਟ ਨਾ ਲੱਗੇ ਸਾਈਕਲ ਚਲਾਉਣਾ ਇੱਕ ਬਹੁਤ ਵਧੀਆ ਗੱਲ ਹੈ ਇਨਵਾਇਰਨਾਮੈਂਟ ਵੀ ਇਹਦੇ ਨਾਲ ਸੇਵ ਹੁੰਦਾ ਕਿਉਂਕਿ ਆਪਾਂ ਕੋਈ ਫਿਊਲ ਵਗੈਰਾ ਨਹੀਂ ਫੂਕਦੇ ਇਹਦੇ ਵਿੱਚ ਜੇ ਆਪਾਂ ਬਾਈਕ 'ਤੇ ਜਾਂਦੇ ਹਾਂ ਕਿਤੇ ਵੀ ਆਪਾਂ ਨੂੰ ਘੱਟੋ ਘੱਟ ਇਨਵਾਇਰਨਾਮੈਂਟ ਤਾਂ ਨਹੀਂ ਖਰਾਬ ਕਰਦੇ ਸਾਈਕਲ ਚਲਾ ਕੇ ਆਪਾਂ ਨੂੰ ਸਾਈਕਲ ਜ਼ਿਆਦਾ ਚਲਾਉਣਾ ਚਾਹੀਦਾ ਪੰਜ ਸੱਤ ਕਿਲੋਮੀਟਰ ਦੇ ਏਰੀਏ 'ਚ ਆਪਾਂ ਨੂੰ ਸਾਈਕਲ ਹੀ ਚਲਾਉਣਾ ਚਾਹੀਦਾ ਤਾਂ ਕਿ ਆਪਾਂ ਇਨਵਾਇਰਨਾਮੈਂਟ ਵੀ ਸੇਵ ਕਰ ਸਕੀਏ ਦੂਸਰੀ ਗੱਲ ਹੈ ਵੀ ਜਦੋਂ ਆਪਾਂ ਯਾਤਰਾ ਦੌਰਾਨ ਬਾਹਰ ਜਾਂਦੇ ਹਾਂ ਕਿਤੇ ਤਾਂ ਆਪਾਂ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈਂਦੇ ਹਾਂ ਨਾਲ ਜਿਵੇਂ ਕਿ ਸਾਰਿਆਂ ਨਾਲੋਂ ਪਹਿਲਾਂ ਆਪਣਾ ਲਾਈਸੈਂਸ ਹੋ ਗਿਆ ਡਰਾਈਵਰੀ ਲਾਈਸੈਂਸ ਇੱਕ ਆਪਣਾ ਦੋ ਨੰਬਰ 'ਤੇ ਆਧਾਰ ਕਾਰਡ ਹੋ ਗਿਆ ਤਾਂ ਇਹ ਗੱਲਾਂ ਅਤੇ ਆਪਣਾ ਪੋਲਿਊਸ਼ਨ ਵਗੈਰਾ ਹੋ ਗਿਆ ਬਾਇਕ ਜੇ ਆਪਾਂ ਨਾਲ ਲਿਜਾਨੇ ਹਾਂ ਬੀਮਾ ਵਗੈਰਾ ਉਹ ਸਾਰਾ ਕੁਛ ਨਾਲ ਲੈ ਜਾਂਦੇ ਹਾਂ ਆਪਾਂ ਇਹ ਗੱਲਾਂ ਧਿਆਨ ਰੱਖਣ ਯੋਗ ਨੇ ਅਤੇ ਮਹੱਤਵਪੂਰਨ ਨੇ